ਹਾਂਜੀ ਹਾਂਜੀ ਹਾਂਜੀ ਅਸੀਂ ਸਾਡਾ ਨਾ ਕੁੱਤਾ ਏ ਮੋਤੀ ਜੋ ਉਹ ਨਾ ਖਾਣ ਪੀਣ ਛੱਡਤਾ ਉਹਨੇ ਕੁਛ ਨਾ ਖਾਂਦਾ ਘੱਟ ਐ ਉਹਦੇ ਵਾਸਤੇ ਕੋਈ ਆਪਾਂ ਦਵਾਈ ਦਾਰੂ ਵੀ ਕੀ ਕਾਰਨ ਉਹਨੂੰ ਟੀਕਾ ਤਾਂ ਨਹੀਂ ਲਗਵਾਇਆ ਜਿਵੇਂ ਨਾ ਸਾਨੂੰ ਇਹ ਲੱਗਿਆ ਵੀ ਉਹਨੇ ਇੱਕ ਦਿਨ ਕੁਛ ਬਾਹਰੋਂ ਖਾ ਲਿਆ ਕੋਈ ਉਹਨੂੰ ਬੱਚੇ ਨੇ ਕੁਝ ਪਾ ਤਾ ਪਤਾ ਨਹੀਂ ਕੀ ਪਾਇਆ ਉਹਨੂੰ ਕੋਈ ਖਾਣ ਵਾਲੀ ਚੀਜ਼ ਦਾ ਹੀ ਵਾਧਾ ਘਾਟਾ ਹੋ ਗਿਆ ਉਹ ਉਲਟੀਆਂ ਵੀ ਕਰਦਾ ਜੀ ਉਹ ਹਾਂਜੀ ਹੈਗੀ ਆ ਝੱਗ ਵੀ ਹੈਗੀ ਆ ਤੇ ਪਰ ਕੁਝ ਖਾਂਦਾ ਪੀਂਦਾ ਨਹੀਂ ਸੁਸਤ ਸੁੱਤਾ ਹੀ ਰਹਿੰਦਾ ਸੌ ਜਾਂਦਾ ਏ ਡਿੱਗ ਪੈਂਦਾ ਉੱਠ ਖੜਦਾ ਪੈ ਜਾਂਦਾ ਉੱਠ ਖੜਦਾ ਪੈ ਜਾਂਦਾ ਹ ਤੇ ਇਦਾਂ ਹੋ ਜਾਂਦਾ ਉਹ ਓਕੇ ਨਹੀਂ ਨਹੀਂ ਉਵੇਂ ਨੀ ਉਵੇਂ ਨੀ ਕੁਛ ਹੋਇਆ ਜਿਵੇਂ ਉਹਨੂੰ ਨਾ ਕੁਛ ਬੱਚਿਆਂ ਨੇ ਕੋਈ ਨਹੀਂ ਉਹਦੇ ਪਚਣ ਖਾਣ ਵਾਲੀ ਚੀਜ਼ ਹੋਊਗੀ ਉਹ ਪਾਤੀ ਬਾਹਰ ਬੱਚੇ ਖੇਡਦੇ ਸੀਗੇ ਛੋਟੇ ਛੋਟੇ ਤੇ ਉਹਦੇ ਨਾਲ ਪਿਆਰ ਵੀ ਕਰਦੇ ਸੀ ਤੇ ਅਹੀਂ ਘੁਮਾਉਣ ਲੈ ਕੇ ਗਏ ਸੀ ਉਹਨਾਂ ਨੇ ਕੁਝ ਪਾਇਆ ਤੇ ਜਿਵੇਂ ਨਾ ਉਹ ਡਿੱਗ ਵੀ ਪੈਂਦਾ ਉਹ ਨਾ ਖੜਾ ਖੜਾ ਤੇ ਉਹ ਕੰਬਣ ਲੱਗ ਜਾਂਦਾ ਕੰਬਦਾ ਕੰਬਦਾ ਤੇ ਮੁੜ ਕੇ ਉਹ ਡਿੱਗ ਪੈਂਦਾ ਤੇ ਫਿਰ ਥੋੜਾ ਚਿਰ ਬਾਅਦ ਆਪ ਹੀ ਉਹ ਸਟੇਬਲ ਹੋ ਜਾਂਦਾ ਅੱਛਾ ਜੀ ਅੱਛਾ ਅੱਛਾ ਜੀ ਤੇ ਤੇ ਅਸੀਂ ਸ਼ੋਪ ਤੇ ਆਈਏ ਕਿ ਤੁਸੀਂ ਆ ਕੇ ਦਵਾਈ ਤੁਹਾਨੂੰ ਦੇ ਕੇ ਜਾਓਗੇ ਹਾਂਜੀ ਅੱਛਾ ਓਕੇ ਤੇ ਕਿਸ ਕ ਵੇਲੇ ਤੱਕ ਆ ਸਕਦੇ ਆਂ ਅਸੀਂ ਠੀਕ ਹ ਜੀ ਤੇ ਅੱਜ ਹੋਰ ਉਹਨਾਂ ਨੂੰ ਤਾਂ ਕੁਝ ਹੈ ਨਹੀਂ ਗਾ ਤੇ ਪਰ ਆਹੀ ਉਹਨਾਂ ਨੂੰ ਯਾਦ ਆਇਆ ਵੀ ਉਲਟ ਦਾ ਵੀ ਜੇ ਕੋਈ ਮਾੜੀ ਮੋਟੀ ਵੀ ਚੀਜ ਪਾ ਦਈ ਦੀ ਆ ਤੇ ਉਲਟੀ ਕਰ ਜਾਂਦਾ ਤੇ ਹੁਣ ਅਸੀਂ ਹੁਣ ਤਾਂ ਕਵੇਲਾ ਹੋ ਗਿਆ ਹੁਣ ਤਾਂ ਅਸੀਂ ਆ ਨਹੀਂ ਸਕਦੇ ਤੇ ਜੇ ਅਸੀਂ ਕੁਝ ਘਰੇ ਕੋਈ ਉਹਦਾ ਕੋਈ ਇਲਾਜ ਕਰ ਸਕਦੇ ਹੋ ਉਨਾ ਚਿਰ ਰਾਤ ਜੇ ਉਹਦੀ ਸਹੀ ਨਿਕਲੇ ਤਾਂ ਹਾਂਜੀ ਅੱਛਾ

ਤੇ ਠੀਕ ਹ ਠੀਕ ਹ ਤੇ ਉਹਨੂੰ ਹੋਰ ਆਪਾਂ ਖਾਣ ਪੀਣ ਨੂੰ ਕੀ ਦੇ ਸਕਦੇ ਆਂ ਵੀ ਉਲਟ ਤਾਂ ਜਾਂਦਾ ਖਾ ਵੀ ਲੈਂਦਾ ਥੋੜਾ ਬਹੁਤ ਪਰ ਫਿਰ ਉਲਟ ਜਾਂਦਾ ਵਾ ਓਕੇ ਓਕੇ ਓਕੇ ਓਕੇ ਥੈਂਕਯੂ